ਪੰਜਾਬ ਇੱਕ ਰਲਿਆ ਮਿਲਿਆ ਸੁਮੇਲ ਹੈ ਇਸ ਵਿੱਚ ਹਰ ਧਰਮ ਹਰ ਕਿੱਤੇ ਦੇ ਲੋਕ ਰਹਿੰਦੇ ਹਨ ਉਹਨਾਂ ਦਾ ਆਪਣਾ ਆਪਣਾ ਸੱਭਿਆਚਾਰ ਹੈ ਆਪਣਾ ਆਪਣਾ ਰੀਤੀ ਤਿਉਹਾਰ ਨੇ ਆਪਣੇ ਆਪਣੇ ਰਿਵਾਜ਼ ਨੇ ਪਰ ਸਿੱਖ ਧਰਮ ਦੇ ਵਿੱਚ ਇਹਨਾਂ ਚੀਜ਼ਾਂ ਦਾ ਰੰਗੋਲੀ ਹੋਇਆ ਸੂਰਜ ਨੂੰ ਪਾਣੀ ਚੜ੍ਹਾਉਣਾ ਮੱਥੇ 'ਤੇ ਸੰਧੂਰ ਪਵਿੱਤਰ ਧਾਗਾ ਪੂਜਾ ਲਈ ਮੰਦਰ ਜਾਣਾ ਦਰਗਾਹ ਜਾਣਾ ਹੋਇਆ ਇਹਨਾਂ ਦੀ ਬਹੁਤ ਹੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ ਆ ਅਤੇ ਇਹ ਇਸ ਦੀ ਸੰਪੂਰ ਪੂਰਨ ਤੌਰ 'ਤੇ ਮਨਾਹੀ ਹੈ ਸਿੱਖ ਧਰਮ ਦੇ ਵਿੱਚ ਇਹਨਾਂ ਚੀਜ਼ਾਂ ਨੂੰ ਅਸੀਂ ਜਦੋਂ ਅਸੀਂ ਅੰਮ੍ਰਿਤ ਪ ਪ੍ਰਵਾਨ ਕਰ ਲੈਦੇ ਹਾਂ ਤਾਂ ਸਿੱਖ ਇਹ ਚੀਜ਼ਾਂ ਸਾਡੇ ਤੋਂ ਬਹੁਤ ਦੂਰ ਹੋ ਜਾਂਦੀਆਂ ਪਰ ਪੰਜਾਬ ਆ ਇਸ ਰਲੇ ਮਿਲੇ ਪੰਜਾਬ ਦੇ ਵਿੱਚ ਸਾਨੂੰ ਸਭ ਦੇ ਧਰਮਾਂ ਦਾ ਸਭ ਦੇ ਸਤਿਕਾਰ ਸਭ ਦੇ ਸੱਭਿਆਚਾਰ ਦਾ ਸਭ ਦੇ ਰੀਤੀ ਰਿਵਾਜ਼ ਦਾ ਸਨਮਾਨ ਕਰਨਾ ਚਾਹੀਦਾ ਹੈ ਅਤੇ ਰਲ ਮਿਲ ਕੇ ਰਹਿਣਾ ਚਾਹੀਦਾ ਹੈ ਅਤੇ ਜੋ ਵੀ ਆਪਣਾ ਜਿਵੇਂ ਮੁਸਲਮਾਨ ਭਰਾ ਆਪਣੇ ਰੋਜ਼ਾ ਰੱਖਦੇ ਨੇ ਅਤੇ ਹਿੰਦੂ ਭਰਾ ਮੰਦਰ ਜਾਂਦੇ ਨੇ ਧਾਗਾ ਪਾਉਂਦੇ ਨੇ ਅਤੇ ਸੂਰਜ ਨੂੰ ਪਾਣੀ ਦਿੰਦੇ ਨੇ ਉਹ ਉਹਨਾਂ ਨੂੰ ਪ੍ਰਵਾਨ ਆ ਉਹਨਾਂ ਨੂੰ ਮ ਉਹਨਾਂ ਨੂੰ ਮੁਬਾਰਕਾਂ ਉਹ ਚੀਜ਼ ਦੀਆਂ ਪਰ ਸਿੱਖ ਧਰਮ ਦੇ ਵਿੱਚ ਇਸ ਚਰਾ ਇਸ ਤਰ੍ਹਾਂ ਦੀ ਕੋਈ ਵੀ ਚੀਜ਼ ਪ੍ਰਵਾਨ ਨਹੀਂ ਹੈ ਇਹ ਸਾਡੇ ਸੱਭਿਆਚਾਰ ਦਾ ਹਿੱਸਾ ਤਾਂ ਏ ਕਿਉਂਕਿ ਪੰਜਾਬ ਇੱਕ ਰ ਰਲਿਆ ਮਿਲਿਆ ਸੁਮੇਲ ਹੈ ਜ ਤਾਂ ਕਰਕੇ ਇਸ ਨੂੰ ਸਭ ਚੀਜ਼ਾਂ ਸਾਡੇ ਸਾਹਮਣੇ ਸਾਡੇ ਆਲੇ ਦੁਆਲੇ ਵਰਤਦੀਆਂ ਰਹਿੰਦੀਆਂ ਨੇ ਅਤੇ